ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਸਤਿ ਸ਼੍ਰੀ ਅਕਾਲ ਵਧੀਆ ਵਧੀਆ ਭਾਅ ਜੀ ਤੁਸੀਂ ਸੁਣਾਓ ਅੱਛਾ ਹਾਂਜੀ ਹਾਂਜੀ ਭਾਅ ਜੀ ਮੈਂ ਪਛਾਣ ਲਏ ਮੈਨੂੰ ਦੱਸਿਆ ਸੀਗਾ ਰਮਨ ਭਾਅ ਜੀ ਨੇ ਗੁਰਦੀਪ ਭਾਅ ਜੀ ਬੋਲਦੇ ਸਭ ਠੀਕ ਠਾਕ ਭਾਅ ਜੀ ਤੁਸੀਂ ਸੁਣਾਓ ਕਿੱਦਾਂ ਨਹੀਂ ਮੈਂ ਕੰਮ ਪਰ ਸੀ ਭਾਅ ਜੀ ਅੱਛਾ ਅੱਛਾ ਭਾਅ ਜੀ ਅੱਛਾ ਭਾਅ ਜੀ ਭਾਅ ਜੀ ਰੇ ਹਾਂਜੀ ਹਾਂਜੀ ਮੈਂ ਕਿਹਾ ਜੀ ਇਹ ਰੇਹੜੀਆਂ ਵਾਲੇ ਤਾਂ ਬਸ ਰੇਹੜੀਆਂ ਵਾਲਿਆਂ ਦਾ ਬਸ ਇੱਦਾਂ ਹੀ ਹੈ ਜੀ ਹਾਲ ਇਹ ਤਾਂ ਇੱਦਾ ਹੀ ਖਾਦਾਂ ਖੁਦਾਂ ਵਾਲੀਆਂ ਵਾਕ ਕੇ ਲਿਆਈ ਜਾਂਦੇ ਆ ਪੈਸਟੀਸਾਈਡ ਵਾਧੂ ਹੁੰਦੇ ਪਾਏ ਵੇ ਵਿੱਚ ਅਤੇ ਉੱਦਾਂ ਸਿਹਤ ਨੂੰ ਜੀ ਬਹੁਤ ਨੁਕਸਾਨ ਆ ਜੀ ਇਹਨਾਂ ਦਾ ਤਾਂ ਭਾਅ ਜੀ ਆਪਣੇ ਇੱਥੇ ਰੇਲਵੇ ਫਾਟਕ ਹੈਗੇ ਆ ਨਾ ਅੱਗੇ ਜਾ ਕੇ ਇਹ ਦੋ ਕਿਲੋਮੀਟਰ ਆਪਣੇ ਹਾਂਜੀ ਹਾਂਜੀ ਹਾਂ ਜਿੱਧਰੋ ਆਉਂਦੇ ਹੀ ਹੈਗੇ ਉਹ ਫਾਟਕਾਂ ਦੇ ਨਾਲ ਹੀ ਨਾ ਪਿੱਛੇ ਸਬਜ਼ੀ ਮੰਡੀ ਪੈਂਦੀ ਹੈ ਭਾਅ ਜੀ ਭਾਅ ਜੀ ਸਾਰੀ ਵੀ ਨਹੀਂ ਹੈਗੇ ਚੁਰੰਜਾ ਨੰਬਰ ਦੁਕਾਨ ਆ ਪਿੱਛੇ ਨੂੰ ਜਾ ਕੇ ਆਪਣੇ ਯਾਰ ਦੋਸਤ ਹੀ ਹੈਗੇ ਮੁੰਡੇ ਹਾਂਜੀ ਤੇ ਉਹ ਵਧੀਆ ਹੁੰਦੀ ਇਹਨਾਂ ਦੀ ਸਬਜ਼ੀ ਕਦੇ ਕੰਪਲੇਂਟ ਆਈ ਨਹੀਂ ਹੈਗੀ ਅੱਜ ਤੱਕ ਅਸੀਂ ਵੀ ਉਹਨਾਂ ਤੋਂ ਹੀ ਚੁੱਕੀ ਦੀ ਆ ਜ਼ਿਆਦਾਤਰ ਉਹ ਵੀ ਉਹ ਵੀ ਭਾਅ ਜੀ ਹੈਗੇ ਆ ਹੈਗੇ ਆ ਇੱਥੇ ਆਪਣਾ ਪਿੰਡ ਲੰਘ ਕੇ ਨਾਲ ਹੀ ਪਿੰਡ ਨਹੀਂ ਆਉਂਦਾ ਹੈਗਾ ਜੀ ਇੱਥੇ ਨੈਣਵਾਂ ਇਹ ਭਾਅ ਜੀ ਇੱਥੇ ਮੁਸਲਮਾਨ ਬੈਠੇ ਹੈਗੇ ਆ ਯਾਰ ਉਹ ਉਹ ਬੀਜਦੇ ਹੈਗੇ ਆਪਣੇ ਦੇਖਿਆ ਹੋਣਾ ਤੁਸੀਂ ਆਉਂਦੇ ਜਾਂਦੇ ਨੇ ਕਿਤੇ ਤੁਹਾਡਾ ਧਿਆਨ ਬੱਜਿਆ ਵੀ ਹੋਣਾ ਹੈਗਾ ਹਾਂ ਉਹ ਭਾਅ ਜੀ ਉਹ ਤਾਜ਼ੀ ਦਿੰਦੇ ਹੈਗੇ ਸਬਜ਼ੀ ਸਾਰੀ ਤੇ ਥੋੜ੍ਹਾ ਜਿਹਾ ਰੇਟ ਮਾੜਾ ਮੋਟਾ ਮਹਿੰਗਾ ਹੁੰਦਾ ਉਹਨਾਂ ਦਾ ਪਰ ਐਂ ਵੀ ਚੀਜ਼ ਵਧੀਆ ਹੈਗੀ ਮੈਂ ਭਾਅ ਜੀ ਉਹ ਹੀ ਮੈਨੂੰ ਤਾਂ ਸ਼ਾਮ ਏ ਹੋ ਜਾਣੀ ਹੈਗੀ ਪਰ ਜੇ ਉਹ ਭਾਅ ਜੀ ਚੁਰੰਜਾ ਨੰਬਰ ਦੁਕਾਨ 'ਤੇ ਜ਼ਰੂਰ ਜ਼ਰੂਰ ਭਾਅ ਜੀ ਦੱਸ ਦਿਓ ਹੈ ਨਾ ਜਿੱਦਾਂ ਵੀ ਹੋਇਆ ਹਾਂ ਹਾਂ ਕਿਉਂਕਿ ਮੈਂ ਤਾਂ ਜਾਣਾ ਹੀ ਹੁੰਦਾ ਲੈਣ ਮੈਂ ਹੀ ਲਿਆਉਂਗਾ ਜ਼ਿਆਦਾ ਗੱਲ ਹੋਈ ਅਗਰ ਤੁਹਾਨੂੰ ਨਹੀਂ ਟੈਮ ਟੂਮ ਮਿਲਿਆ ਹੈ ਨਾ ਤਾਂ ਵੀ ਦੱਸ ਦਿਓ ਠੀਕ ਹੈ ਭਾਅ ਜੀ ਠੀਕ ਹੈ ਓਕੇ ਜੀ ਓਕੇ